ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਹੀ ਜ਼ਿਆਦਾ ਰੰਗ ਭਰਿਆ ਹੈ ਇੱਥੇ ਦੇ ਲੋਕ ਜਿਹੜੇ ਨੇ ਉਹ ਬਹੁਤ ਹੀ ਮਿਲਣਸਾਰ ਨੇ ਅਤੇ ਇੱਥੇ ਦਾ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਰੰਗਲਾ ਹੈ ਇੱਥੋਂ ਦੇ ਲੋਕ ਜਿਹੜੇ ਨੇ ਉਹ ਆਪਣੇ ਸੱਭਿਆਚਾਰ ਨੂੰ ਸਾਂਭੀ ਬੈਠੇ ਨੇ ਅਤੇ ਉਹ ਪੂਰੀ ਕੋਸ਼ਿਸ਼ ਕਰਦੇ ਨੇ ਕਿ ਉਹ ਆਪਣੇ ਸੱਭਿਆਚਾਰ ਨੂੰ ਆਪਣੀ ਆਉਣ ਵਾਲੀ ਪੀੜੀਆਂ ਤੱਕ ਲੈ ਕੇ ਜਾਣ ਅਤੇ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਸਾਰਿਆਂ ਧਰਮਾਂ ਨੂੰ ਆਪਣੇ ਨਾਲ਼ ਲੈ ਕੇ ਚੱਲਣਾ ਚਾਹੁੰਦਾ ਹੈ ਪਰ ਜਿਹੜੇ ਕੁਝ ਲੋਕ ਨੇ ਉਹ ਇੱਥੇ ਦੇ ਕਲਚਰ ਨੂੰ ਇੱਥੇ ਦੇ ਸੱਭਿਆਚਾਰ ਨੂੰ ਗ਼ਲਤ ਤਰੀਕੇ ਨਾਲ਼ ਦੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਸੱਭਿਆਚਾਰ ਜ਼ਿਆਦਾ ਹੀ ਪੁਰਾਣਾ ਹੈ ਅਤੇ ਅਸੀਂ ਲੋਕ ਜਿਹੜੇ ਹੈ ਆਪਣੇ ਪੁਰਾਣੇ ਹੀ ਸੱਭਿਆਚਾਰ ਨੂੰ ਲਈ ਬੈਠੇ ਹੈ ਅਸੀਂ ਆਉਣ ਵਾਲੀ ਪੀੜੀ ਦੇ ਨਾਲ਼ ਨਹੀਂ ਚੱਲਦੇ ਬਲਕਿ ਇਹ ਗੱਲ ਗ਼ਲਤ ਹੈ ਜਿਹੜਾ ਧਰਮ ਜਿਹੜਾ ਹੁੰਦਾ ਹੈ ਜਿਹੜਾ ਵੀ ਕੌਮ ਹੁੰਦੀ ਹੈ ਉਹ ਆਪਣੇ ਜਦ ਤੱਕ ਆਪਣੇ ਸੱਭਿਆਚਾਰ ਨੂੰ ਨਹੀਂ ਸਾਂਭੇਗੀ ਉਹ ਆਪਣੀ ਆਉਣ ਵਾਲੀ ਪੀੜੀਆਂ ਨੂੰ ਵਿਰਾਸਤ ਵਿੱਚ ਕੁਝ ਨਹੀਂ ਦੇ ਸਕਦੀ ਅਤੇ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਕੋਲੇਜਾਂ ਵਿੱਚ ਹਰੇਕ ਸੱਭਿਆਚਾਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਵੇ ਅਤੇ ਮੈਨੂੰ ਮੇਰੇ ਸੱਭਿਆਚਾਰ 'ਤੇ ਬਹੁਤ ਹੀ ਜ਼ਿਆਦਾ ਮਾਣ ਹੈ